ਮੈਨੂੰ ਬਾਈਕਿੰਗ ਕਰਨ ਲਈ ਸਭ ਤੋਂ ਵੱਧ ਮੇਰੇ ਦੋਸਤਾਂ ਨੇ ਪ੍ਰੇਰਿਤ ਕੀਤਾ ਜੋ ਅਕਸਰ ਹੀ ਬਾਈਕਿੰਗ ਟੂਰ ਟਰਿਪ ਕਰਦੇ ਰਹਿੰਦੇ ਹਨ ਜੋ ਕਿ ਲਦਾਖ ਵਗੈਰਾ ਵਰਗੀਆਂ ਅ ਜਗ੍ਹਾ ਤੇ ਬ ਬਾਈਕਿੰਗ ਦੁਆਰਾ ਜਾਂਦੇ ਰਹਿੰਦੇ ਹਨ ਇਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਪ੍ਰੇਰਿਤ ਕੀਤਾ ਕੁਝ ਸਾਲਾਂ ਦੌ ਕਈ ਸਾਲਾਂ ਵਿੱਚ ਮੇਰਾ ਐਕਸਪੀਰੀਅੰਸ ਹੈ ਇਸ 'ਚ ਬਹੁਤ ਜ਼ਿਆਦਾ ਚੰਗਾ ਰਿਹਾ ਅਤੇ ਹੌਲੀ ਹੌਲੀ ਮੇਰਾ ਇੰਟਰਸਟ ਇਸ 'ਚ ਬਹੁਤ ਜ਼ਿਆਦਾ ਵਧਦਾ ਰਿਹਾ ਜਿਸ ਨਾਲ ਮੈਂ ਇੰਡੀਪੈਂਡੈਂਟ ਬਣਦੀ ਰਹੀ ਅਤੇ ਮੈਨੂੰ ਮੈਂ ਆਪਣੇ ਆਪਣੇ ਵਿੱਚ ਖੁੱਲ੍ਹ ਕੇ ਜਿਉਣ ਲੱਗੀ ਜੋ ਕਿ ਸਾਡੇ ਲਈ ਬਹੁਤ ਜ਼ਰੂਰੀ ਹੈ ਇਸ ਨਾਲ ਬਾਈ ਬਾਈਕਿੰਗ ਲਈ ਮੈਂ ਸਭ ਤੋਂ ਵੱਧ ਬਾਈਕਿੰਗ ਵੀਡੀਓਜ ਦੇਖੀਆਂ ਜਿਸ ਨਾਲ ਮੈਨੂੰ ਜ਼ਿਆਦਾ ਇੰਟਰਸਟ ਵਧਿਆ ਅਤੇ ਮੈਂ ਇਸ ਵਿੱਚ ਹੋਰ ਜ਼ਿਆਦਾ ਇਹ ਅਤੇ ਮੈਂ ਬਾਈਕਿੰਗ ਰਾਹੀਂ ਲੇ ਲੇਹ ਲਦਾਖ ਅਤੇ ਹਰੇਕ ਜਗ੍ਹਾ ਜਾਂਦੀ ਰਹਿੰਦੀ ਹਾਂ ਜੋ ਕਿ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ